ਪੰਜਾਬੀ ਭਾਸ਼ਾ ਪੰਜਾਬੀ ਲੋਕਾਂ ਦੇ ਸਾਂਝੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਕਰਦੀ ਹੈ ਉਹਨਾਂ ਦੀਆਂ ਸਮਾਂ ਹਿਰਾਸਤ ਪਰਵਾਨ ਪ੍ਰੰਪਰਾਵਾਂ ਅਤੇ ਮੁੱਲਾਂ ਦੇ ਦੀ ਭਾਵਨਾ ਦਾ ਇੱਕ ਸਾਧਨ ਬਣਦੀ ਹੈ ਇਸ ਨੇ ਵਿੱਚੋਂ ਹੋਣ ਵਾਲੇ ਕਲਾ ਰੂਪ ਵਿਖੇ ਕਿ ਸਾਹਿਤ ਸੰਕਤ ਅਤੇ ਕਵਿਤਾ ਵਿੱਚ ਬੇਹੱਦ ਮਹੱਤਵਪੂਰਨ ਭੁਮਿਕਾ ਅਦਾ ਕੀਤੀ ਹੈ ਆਪਣੇ ਪਰਯਤ ਅਤੇ ਸੰਚਾਰਿਕ ਪਰਿਯਤਮਤਾ ਦੇ ਇੱਕ ਮੱਧ ਤੱਤ ਵ ਵਜਾਂਦੀ ਹੈ ਇਸ ਭਾਸ਼ਾ ਨੇ ਸੋਧੇ ਜਾਣ ਵਾਲੇ ਸੰਚਾਰਿਕ ਸੰਦੇਸ਼ਾਂ ਨੂੰ ਇੱਕ ਪੀੜੇ ਤੋਂ ਦੂਜੇ ਤੱਕ ਸਾਂਝਾ ਕਰਨ ਤੱਕ ਇੱਕ ਸੁਧਾਰ ਕੀਤਾ ਹੈ ਜੋ ਪੰਜਾਬੀ ਸੰਗਤ ਦੀ ਜੀਵਿਤ ਸਮਿਤੀਕ ਦਾਸਤਾਨ ਵਿੱਚ ਮਹੱਤਵਪੂਰਨ ਯੋਗਦਾਨ ਪ੍ਰਦਾਨ ਕਰਦਾ ਹੈ ਇਹ ਭਾਸ਼ਾ ਕਿਤਾਬਾਂ ਕਵਿਤਾ ਲੋਕ ਗੀਤ ਅਤੇ ਵੱਖ ਵੱਖ ਕਲਾ ਰੂਪਾਂ ਦੇ ਜ਼ਰੀਏ ਸਾਂਝੇ ਹੋਏ ਹੋ ਕੇ ਲੋਕਾਂ ਨੂੰ ਆਪਣੇ ਕੁ ਕੁਚਲਰ ਅਤੇ ਵਿਰਾਸਤ ਦੇ ਸਮਿੰਦਿਆ ਨੂੰ ਅਕਸਰ ਰੌਸ਼ਨੀ ਵਿੱਚ ਪੇਸ਼ ਕਰਦੀ ਹੈ ਸਾਹਿਤ ਇਤਿਹਾਸ ਅਤੇ ਧਾਰਮਿਕ ਗ੍ਰੰਥਾਂ ਦੀ ਭਾਸ਼ਾ ਵੱਖ ਵੱਖ ਕਿਸਮਾਂ ਦੇ ਰੂਪ ਵਿੱਚ ਪੰਜਾਬੀ ਵਿੱਚ ਉਤਪੰਨ ਹੋਵੀ ਹੋਈ ਹੈ ਜਿਸ ਨਾਲ ਇਹ ਭਾਸ਼ਾ ਧਾਰਮਿਕ ਵਿਕਾਸ ਵਿੱਚ ਅਹਿਮ ਭੂਮਿਕਾ ਅਦਾ ਕਰਦੀ ਹੈ ਇਸ ਨਾਲ ਇਸ ਨੇ ਵਿੱਚੋਂ ਪੈਦਾ ਹੋਏ ਗੁਰਮੁਖੀ ਲਿਖੀ ਗੁਰਮੁਖੀ ਲਿਪੀ ਦੀਆਂ ਲਗਾਤਾਰ ਵਿਕਾਸਾਂ ਨਾਲ ਵਰਤੀ ਹੈ ਅਤੇ ਇਸ ਨੇ ਲੋਕਾਂ ਦੇ ਵਿਚਾਰਧਾਵਾਂ ਅਤੇ ਅੰਧ ਭਾਵਨਾਵਾਂ ਦੇ ਪਰਵਾਹ ਨੂੰ ਉਜਾਗਰ ਕੀਤਾ ਹੈ ਪੰਜਾਬੀ ਭਾਸ਼ਾ ਨੇ ਲੋਕਾਂ ਦੇ ਆਤਮ ਵਿਸ਼ਵਾਸ ਸੰਬੰਧਾਂ ਅਤੇ ਇਤਿਹਾਸ ਨੂੰ ਹਮੇਸ਼ਾਂ ਜੀਵੰਤ ਰੱਖਿਆ ਹੈ ਅਤੇ ਇਸ ਨੇ ਅਸਲੀਅਤ ਦੀ ਪਰਚਾਈ ਰੱਖਦੀ ਹੈ ਇਸ ਤੋਂ ਇੱਕ ਪੰਜਾਬੀ ਵਿੱਚ ਆਪਣੇ ਮੁੱਲਾਂ ਪ੍ਰੰਪਰਾਵਾਂ ਅਤੇ ਕਲ ਕਲਚਰ ਦਾ ਗਰਵ ਹੈ ਅਤੇ ਇਸਨੇ ਲੋਕਾ ਲੋਕ ਇਕੱਲਤਾ ਦਾ ਮੀਲ ਬਣਾਇਆ ਬਣਾਏ ਰੱਖਿਆ ਹੈ ਇਸ ਇਸ ਤਰ੍ਹਾਂ ਪੰਜਾਬੀ ਭਾਸ਼ਾ ਨੇ ਸੰਸ ਸੰਸਕ੍ਰਿਤ ਖੰਡੇ ਦੇ ਵਿਕਾਸ ਵਿੱਚ ਬੇਹੱਦ ਮੌਲਿਕ ਯੋਗਦਾਨ ਦਿਆ ਹੈ ਅਤੇ ਪੰਜਾਬੀ ਸਮੁੰਦਾ ਦੇ ਸਾਰਾ ਸਾਰੇ ਰੰਗਾਂ ਵਿੱਚ ਉਜਾਗਰ ਕੀਤਾ ਹੈ